ਹਾਂਜੀ ਮੈਂ ਸਿਮਰਨ ਬੋਲ ਰਹੀ ਹਾਂ ਗੁਰਦਾਸਪੁਰ ਤੋਂ ਮੈਂ ਤੁਹਾਡਾ ਆਨਲਾਈਨ ਐਡਰੈਸ ਦੇਖਿਆ ਸੀ ਅਤੇ ਸਾੜੀ ਖਰੀਦੀ ਸੀ ਮੈਂ ਕੁਛ ਟਾਈਮ ਪਹਿਲਾਂ ਅਤੇ ਉਹ ਸਾੜੀ ਮੈਨੂੰ ਬਹੁਤ ਪਸੰਦ ਆਈ ਆ ਆਨਲਾਈਨ ਨੈਟ 'ਤੇ ਵੇਖਿਆ ਸੀ ਤੁਹਾਡਾ ਮੈਂ ਐਡਰਸ ਅਤੇ ਤੁਹਾਨੂੰ ਮੈਂ ਸਾੜੀ ਦਾ ਆਰਡਰ ਕੀਤਾ ਸੀਗਾ ਅਤੇ ਉਹ ਸਾੜੀ ਤੁਸੀਂ ਮੈਨੂੰ ਭੇਜੀ ਮੈਨੂੰ ਹਫ਼ਤੇ 'ਚ ਪਹੁੰਚ ਗਈ ਸੀਗੀ ਉਹ ਸਾੜੀ ਬਹੁਤ ਵਧੀਆ ਨਿਕਲੀ ਆ ਉਹਦਾ ਕੱਪੜਾ ਵੀ ਵ ਵਧੀਆ ਸੀਗਾ ਕਢਾਈ ਵੀ ਵਧੀਆ ਸੀਗੀ ਉਹਦੀ ਅਤੇ ਬੜੀ ਕੰਫਰਟੇਬਲ ਰਹੀ ਉਹ ਅਤੇ ਮੈਂ ਓਦਾਂ ਦੀਆਂ ਕੁਛ ਸਾੜੀਆਂ ਦਾ ਹੋਰ ਆਰਡਰ ਦੇਣਾ ਚਾਹੁੰਦੀ ਹਾਂ ਅਤੇ ਮੇਰੀਆਂ ਦੋਸਤਾਂ ਫਰੈਂਡਾਂ ਨੂੰ ਵੀ ਸਾੜੀ ਉਹ ਬਹੁਤ ਪਸੰਦ ਆਈ ਆ ਅਤੇ ਕੀ ਤੁਸੀਂ ਉਹ ਹੋਰ ਆਰਡਰ ਲੈ ਸਕਦੇ ਹਾਂ ਸੇਮ ਉਸ ਨਾਲ ਦੀਆਂ ਸਾੜੀਆਂ ਦਾ ਅਤੇ ਬਸ ਕਲਰ ਭਾਵੇਂ ਚੇਂਜ ਕਰ ਦਿਓ ਰੰਗ ਚੇਂਜ ਕਰ ਦਿਓ ਅਤੇ ਓਦਾਂ ਦੀਆਂ ਹੋਰ ਪੰਜ ਛੇ ਸਾੜੀਆਂ ਦਾ ਮੈਂ ਤੁਹਾਨੂੰ ਆਰਡਰ ਲਿਖਾਉਂਦੀ ਹਾਂ ਅਤੇ ਲੈ ਲਿਓ ਉਹ ਸਾੜੀ ਦਾ ਕੱਪੜਾ ਵੀ ਬਹੁਤ ਵਧੀਆ ਸੀ ਕਢਾਈ ਵੀ ਵਧੀਆ ਸੀ ਵੈਸੇ ਵੀ ਕੰਮਫ਼ਰਟੇਬਲ ਸੀ ਅਤੇ ਵਧੀਆ ਲੱਗੀ ਉਹ ਸਾੜੀ ਤੁਹਾਡੀ ਮੈਨੂੰ